ਮੇਰੇ ਚੱਲਣ ਵਾਲੇ ਜੁੱਤੇ ਬਹੁਤ ਹੀ ਆਰਾਮਦਾਇਕ ਹੁੰਦੇ ਹਨ ਅਤੇ ਮੈਂ ਜਦੋਂ ਸਵੇਰੇ ਰਨਿੰਗ ਕਰਨ ਜਾਂਦੀ ਹਾਂ ਤਾਂ ਮੇਰੇ ਸ ਸਪੋਰਟਸ ਵਾਲੇ ਹੀ ਸ਼ੂਜ ਪਾਏ ਹੁੰਦੇ ਹਨ ਅਤੇ ਮੈਂ ਲੋਅਰ ਟੀ ਸ਼ਲਟ ਵਿੱਚ ਜਾਂਦੀ ਇਹਨਾਂ ਵਿੱਚ ਮੈਂ ਬਹੁਤ ਜ਼ਿਆਦਾ ਕੰਫਰਟੇਬਲ ਰਹਿੰਦੀ ਹਾਂ ਅਤੇ ਰਨਿੰਗ ਕਰਨੀ ਮੈਨੂੰ ਆਸਾਨ ਰਹਿੰਦੀ ਹੈ ਅਤੇ ਸਪੋਰਟਸ ਵਾਲੇ ਜੁੱਤੇ ਬਿਲਕੁਲ ਕੱਪੜੇ ਦੀ ਤਰ੍ਹਾਂ ਹੁੰਦੇ ਹਨ ਕੋਈ ਇਹਨਾਂ ਵਿੱਚ ਅਨਕੰਫਰਟੇਬਲ ਫੀਲ ਨਹੀਂ ਹੁੰਦਾ ਬਿਲਕੁਲ ਕੰਫਰਟੇਬਲ ਫੀਲ ਹੁੰਦਾ ਹੈ ਅਤੇ ਵਧੀਆ ਰਨਿੰਗ ਕੀਤੀ ਜਾਂਦੀ ਹੈਗੀ ਸਵੇਰੇ ਮੈਂ ਜਦੋਂ ਰਨਿੰਗ ਕਰਨ ਜਾਂਦੀ ਹਾਂ ਉਦੋਂ ਲੋਅਰ ਟੀ ਸ਼ਰਟ ਜਾਂ ਟਰੈਕ ਸੂਟ ਪਹਿਣ ਕੇ ਜਾਂਦੀ ਹਾਂ ਅਤੇ ਵਧੀਆ ਮੈਥੋਂ ਰਨਿੰਗ ਹੁੰਦੀ ਹੈਗੀ ਹੈ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਕੰਫਰਟੇਬਲ ਹੁੰਦੀ ਹੈਗੀ ਕੋਈ ਵੀ ਸੂਟ ਜਾਂ ਲੋਅਰ ਟੀ ਸ਼ਰਟ ਜਾਂ ਜੀਨ ਟੋਪ ਪਾਉਂਦੀ ਹਾਂ ਮੈਂ ਉਸ ਵਿੱਚ ਵੀ ਕੰਫਰਟੇਬਲ ਰਹਿੰਦੀ ਹੈਗੀ ਕੋਈ ਵੀ ਪਹਿਰਾਵੇ ਵਿੱਚ ਜਾਵਾਂ ਤਾਂ ਮੈਨੂੰ ਬਹੁਤ ਵਧੀਆ ਕੰਫਰਟੇਬਲ ਰਹਿੰਦਾ ਹੈ ਅਤੇ ਜੁੱਤੇ ਦੀ ਗੱਲ ਕੀਤੀ ਜਾਵੇ ਤਾਂ ਜੁੱਤੇ ਵਿੱਚ ਮੈਂ ਹਰੇਕ 'ਚ ਕੰਫਰਟੇਬਲ ਫੀਲ ਹੁੰਦਾ ਕਿਸੇ 'ਚ ਅਨਕੰਫਰਟੇਬਲ ਫੀਲ ਨਹੀਂ ਹੁੰਦਾ ਜ਼ਿਆਦਾ ਮੈਨੂੰ ਸਪੋਰਟਸ ਵਾਲੇ ਜੁੱਤੇ ਵਿੱਚ ਹੀ ਜ਼ਿਆਦਾ ਤਾਂ ਫੀਲ ਕੰਫਰਟੇਬਲ ਫੀਲ ਉਹਦੇ ਵਿੱਚ ਹੀ ਹੁੰਦਾ ਕਿਉਂਕਿ ਰਨਿੰਗ ਕਰਨੀ ਬਹੁਤ ਜ਼ਿਆਦਾ ਆਸਾਨ ਹੁੰਦੀ ਹੈ ਰਨਿੰਗ ਕਰਨ ਵਾਸਤੇ ਵਧੀਆ ਮੈਂ ਸਵੇਰੇ ਜਲਦੀ ਉੱਠ ਕੇ ਜਾਂਦੀ ਹੈਗੀ ਆਪਣਾ ਟਰੈਕ ਸੂਟ ਪਹਿਨਦੀ ਹਾਂ ਸਪੋਰਟਸ ਵਾਲੇ ਬੂਟ ਪਹਿਨਦੀ ਹੈਗੀ ਅਤੇ ਫਿਰ ਮੈਂ ਚਲੀ ਜਾਂਦੀ ਹੈਗੀ ਅਤੇ ਰਨਿੰਗ ਕਰਨੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈਗੀ ਵਧੀਆ ਲੱਗਦੀ ਹੈਗੀ ਅਤੇ ਮੈਂ ਵਧੀਆ ਰਨਿੰਗ ਕਰਦੀ ਹਾਂ ਵਧੀਆ ਮੈਨੂੰ ਸਾਹ ਚੜ੍ਹਨਾ ਹੁਣ ਬਿਲਕੁਲ ਵੀ ਨਹੀਂ ਚੜ੍ਹਦਾ ਪਹਿਲਾਂ ਸਾਹ ਇੰਨਾ ਜ਼ਿਆਦਾ ਚੜ੍ਹਦਾ ਸੀ ਅਤੇ ਹੁਣ ਬਿਲਕੁਲ ਵੀ ਨਹੀਂ ਚੜ੍ਹਦਾ ਅਤੇ ਮੈਂ ਸਪੋਰਟਸ ਵਾਲੇ ਜੁੱਤੇ ਵਿੱਚ ਬਹੁਤ ਜ਼ਿਆਦਾ ਕੰਫਰਟੇਬਲ ਰਹਿੰਦੀ ਹੈਗੀ ਪਹਿਨਣੇ ਕੋਈ ਵੀ ਪਹਿਰਾਵਾ ਕੀਤਾ ਜਾਵੇ ਮੈਂ ਆਪਣਾ ਪਹਿਰਾਵਾ ਕਰਦੀ ਹਾਂ ਤਾਂ ਮੈਂ ਕੰਫਟੇਬਲ ਫੀਲ ਮੈਨੂੰ ਹੁੰਦਾ ਰਹਿੰਦਾ ਹੈਗਾ ਅਤੇ ਕਿਸੇ ਕਿਸੇ ਵੀ ਕੱਪੜੇ 'ਚ ਮੈਨੂੰ ਅਨਕੰਫਰਟੇਬਲ ਫੀਲ ਨਹੀਂ ਹੁੰਦਾ ਵਧੀਆ ਕੰਫਰਟੇਬਲ ਫੀਲ ਰਹਿੰਦਾ